ਹੈਲੋ ਵੀਰੇ ਸਤਿ ਸ਼੍ਰੀ ਅਕਾਲ ਤੁਸੀਂ ਸਵੀਗੀ ਤੋਂ ਗੱਲ ਕਰ ਰਹੇ ਹੋ ਮੈਂ ਰਮਨਦੀਪ ਕੌਰ ਝੁੰਬੇ ਤੋਂ ਵੀਰੇ ਜਿਹੜਾ ਅਸੀਂ ਤੁਹਾਨੂੰ ਔਡਰ ਦਿੱਤਾ ਸੀ ਸਮੋਸਿਆਂ ਦਾ ਉਹ ਅਸੀਂ ਮਤਲਬ ਸਾਨੂੰ ਮਿਲ ਗਿਆ ਹੈ ਅਤੇ ਅਸੀਂ ਸਮੋਸੇ ਜਦ ਬੱਚਿਆਂ ਨੂੰ ਦੇਣ ਲੱਗੇ ਉਸ ਤੋਂ ਪਹਿਲਾਂ ਅਸੀਂ ਇੱਕ ਸਮੋਸਾ ਮਤਲਬ ਕੱਟ ਕੇ ਜਦ ਦੇਖਿਆ ਤਾਂ ਉਹਦੇ ਵਿੱਚ ਬਹੁਤ ਹੀ ਸਮੈਲਿੰਗ ਆ ਰਹੀ ਸੀ ਜਿੱਦਾਂ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਫੈਟ ਹੋਵੇ ਉਹ ਬਹੁਤ ਹੀ ਜ਼ਿਆਦਾ ਓਈਲੀ ਅਤੇ ਬਹੁਤ ਹੀ ਬੇਹੇ ਲੱਗ ਰਹੇ ਸੀ ਸਾਨੂੰ ਉਹ ਬਿਲਕੁਲ ਵੀ ਪਸੰਦ ਨਹੀਂ ਆਏ ਅਸੀਂ ਉਹ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਜਾਂ ਬੱਚਿਆਂ ਨੂੰ ਨਹੀਂ ਖਵਾ ਸਕਦੇ ਜਿਸ ਦੇ ਕਾਰਨ ਉਹ ਬਿਮਾਰ ਹੋ ਸਕਦੇ ਹਨ ਇਸ ਲਈ ਸਾਨੂੰ ਇਹ ਤੁਹਾਡਾ ਇਹ ਭੇਜੇ ਹੋਏ ਸਮੋਸੇ ਸਾਨੂੰ ਬਿਲਕੁਲ ਵੀ ਪਸੰਦ ਨਹੀਂ ਆਏ ਅਤੇ ਤੁਸੀਂ ਜਾਂ ਤਾਂ ਸਾਨੂੰ ਇਸ ਦੇ ਬਦਲੇ ਕੋਈ ਚੰਗੀ ਕੁਆਲਿਟੀ ਚੰਗੀ ਵਧੀਆ ਚੀਜ਼ ਭੇਜ ਦਿਓ ਹੋਰ ਕੁਛ ਖਾਣ ਲਈ ਨਹੀਂ ਸਾਨੂੰ ਸਾਡੇ ਪੈਸੇ ਵਾਪਸ ਕਰ ਦਿਓ ਅਤੇ ਇਸ ਲਈ ਸਾਨੂੰ ਤੁਹਾਡਾ ਇਹ ਮਤਲਬ ਸਮੋਸਿਆਂ ਵਾਲਾ ਜੋ ਵੀ ਅਸੀਂ ਔਡਰ ਦਿੱਤਾ ਸੀ ਸਾਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਇਸ ਕਰਕੇ ਅਸੀਂ ਇਹ ਔਡਰ ਨਹੀਂ ਅਸੀਂ ਲੈ ਸਕਦੇ ਸਾਨੂੰ ਇਹਦੇ ਬਦਲੇ ਸਾਨੂੰ ਕੁਛ ਹੋਰ ਵਧੀਆ ਭੇਜ ਦਿਓ ਨਹੀਂ ਸਾਡੇ ਸਾਨੂੰ ਪੈਸੇ ਵਾਪਸ ਕਰ ਦਿਓ ਅਸੀਂ ਇਹ ਆਪਣੇ ਬੱਚਿਆਂ ਨੂੰ ਖਵਾ ਕੇ ਬਿਮਾਰ ਨਹੀਂ ਕਰਨਾ ਚਾਹੁੰਦੇ ਸਾਨੂੰ ਇੱਦਾਂ ਲੱਗ ਰਿਹਾ ਜਿੱਦਾਂ ਇਹ ਬਹੁਤ ਹੀ ਪੁਰਾਣੇ ਅਤੇ ਬੇਹੇ ਹੋਣ ਇਸ ਲਈ ਅਸੀਂ ਇਸ ਆਪਣੇ ਬੱਚਿਆਂ ਨੂੰ ਜਾਂ ਅਸੀਂ ਆਪਣੇ ਆਪ ਨੂੰ ਪਰਿਵਾਰਿਕ ਨੂੰ ਨਹੀਂ ਖਵਾ ਸਕਦੇ ਸਾਨੂੰ ਸਾਡੇ ਪੈਸੇ ਰਿਟਰਨ ਕਰ ਦਿਓ ਜਾਂ ਸਾਨੂੰ ਇਸ ਤੋਂ ਇਸ ਦੇ ਬਦਲੇ ਕੋਈ ਵਧੀਆ ਹੋਰ ਚੀਜ਼ ਭੇਜ ਦਿਓ ਥੈਂਕ ਯੂ